ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਮ ਮੈਂ ਤੁਹਾਡੇ ਹੀ ਕੋਲੇਜ ਵਿੱਚ ਬੀ ਟੈਕ ਸੀ ਐੱਸ ਈ ਸੈਵਨ ਸੈਮ ਦੀ ਵਿਦਿਆਰਥੀ ਬੋਲਦੀ ਪਈ ਹਾਂ ਮੈਂ ਨਾ ਤੁਹਾਡੇ ਕੋਲ ਜੋਬ ਪਲੇਸਮੈਂਟ ਦੇ ਬਾਰੇ ਕੋਈ ਇਨਕੁਇਰੀ ਲੈਣੀ ਸੀਗੀ ਅੱਜ ਤੁਸੀਂ ਦੱਸ ਸਕਦੇ ਹੋ ਕਿ ਕੋਣ ਕਿਹੜੀਆਂ ਕਿਹੜੀਆਂ ਕੰਪਨੀਆਂ ਆ ਰਹੀਆਂ ਇਸ ਟਾਈਮ 'ਤੇ

ਅੱਛਾ ਮੈਮ ਤੁਸੀਂ ਦੱਸ ਸਕਦੇ ਹੋ ਕਿਹੜੀ ਕਿਹੜੀ ਜੋਬ ਓਪੋਰਚਿਊਨਿਟੀ ਸਾਨੂੰ ਅੰਮ੍ਰਿਤਸਰ 'ਚ ਮਿਲ ਸਕਦੀ ਹੈ ਓਕੇ ਓਕੇ ਠੀਕ ਐ ਮੈਮ ਥੈਂਕ ਯੂ